ਇਹ ਸੱਚ ਹੈ ਕਿ ਸਾਡੇ ਪੰਜਾਬ ਵਿੱਚ ਬਹੁਤ ਹੀ ਬਹੁਤ ਸਾਰਾ ਪ੍ਰਦੂਸ਼ਣ ਫੈਲ ਚੁੱਕਿਆ ਹੈ ਤਾਂ ਜੋ ਕਿ ਪ੍ਰਦੂਸ਼ਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗਦੀਆਂ ਹਨ ਇਹ ਪ੍ਰਦੂਸ਼ਣ ਫੈਕਟਰੀਆਂ ਜਿਵੇਂ ਕਿ ਪਰਾਲੀ ਨੂੰ ਅੱਗ ਲਾ ਕੇ ਜਿਵੇਂ ਘਰਾਂ ਵਿੱਚ ਧੂੰਆਂ ਉਹਦੇ ਨਾਲ ਉਹ ਜਹਿ ਜ਼ਹਿਰੀਲਾ ਹੁੰਦਾ ਹੈ ਉਹ ਧੂੰਆਂ ਜ਼ਹਿਰੀਲਾ ਹੁੰਦਾ ਹੈ ਤਾਂ ਕਿ ਜੋ ਉਹ ਉਹ ਧੂੰਆਂ ਸਾਡੇ ਸਰੀਰ ਦੇ ਅੰਦਰ ਜਾਂਦਾ ਹੈ ਅਤੇ ਅਤੇ ਕਈ ਸਾਰੇ ਅ ਅੰਗਾਂ ਨੂੰ ਉਹ ਕਰ ਦਿੰਦਾ ਨਸ਼ਟ ਕਰ ਦਿੰਦਾ ਤਾਂ ਕਿ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਤੋਂ ਲਈ ਵਟਾਉਣ ਲਈ ਸਾਡੇ ਸਕੂਲਾਂ ਵਿੱਚ ਪ੍ਰੋਜੈਕਟ ਵੀ ਬਣਾਏ ਜਾਂਦੇ ਹਨ ਅਤੇ ਦੂਰੋਂ ਦੂਰੋਂ ਦੂਰੋਂ ਦੂਰੋਂ ਡਾਕਟਰ ਵੀ ਅਤੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਆਉਂਦੇ ਹਨ ਕਿ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਹੈ ਤਾਂ ਕਿ ਹਾਂ ਸ ਸਾਡੇ ਸਾਡੀ ਜ਼ਿੰਦਗੀ ਬਚ ਬਚ ਸਕੇ ਅਤੇ ਫੈਕਟਰੀਆਂ ਵਿੱਚ ਧੂੰਆਂ ਫੈਲ ਰਿਹਾ ਅਤੇ ਉਸ ਨਾਲ ਵੀ ਬੰਦਾ ਨਸ਼ਟ ਹੋ ਜਾਂਦਾ ਹੈ ਅਤੇ ਉਹ ਜ਼ਹਿਰੀਲਾ ਹੁੰਦਾ ਹੈ ਅਤੇ ਬਹੁ ਸਕੂਲਾਂ ਵਿੱਚ ਬਹੁਤ ਸਾਰੀਆਂ ਰੈਲੀਆਂ ਵੀ ਇ ਇਸੇ ਮੁਤਾਬਿਕ ਪ੍ਰਦੂਸ਼ਣ ਮੁਤਾਬਿਕ ਰੈਲੀਆਂ ਵੀ ਕੱਢੀਆਂ ਜਾਂਦੀਆਂ ਹਨ ਕਿਉਂਕਿ ਪ੍ਰਦੂਸ਼ਣ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਫੈਲ ਚੁੱਕਿਆ ਹੈ ਜਿਵੇਂ ਕਿ ਮੋਟਰਸਾਈਕਲਾਂ ਗੱਡੀਆਂ ਕਾਰਾਂ ਦਾ ਪ੍ਰਦੂਸ਼ਣ ਬਹੁਤ ਹੀ ਜ਼ਿਆਦਾ ਹੋ ਚੁੱਕਿਆ ਹੈ ਇਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਪਰੇਸ਼ਾਨੀ ਆ ਆਉਂਦੀ ਹੈ ਕਿਉਂਕਿ ਪ੍ਰਦੂਸ਼ਣ ਹਾਂ ਇੱਕ ਅੱਜ ਅੱਜ ਕੱਲ੍ਹ ਅੱਜ ਕੱਲ੍ਹ ਹਾਂ ਬੱਚਿਆਂ ਦਾ ਹਰ ਇੱਕ ਦਾ ਹਾਂ ਹਰ ਇੱਕ ਦਾ ਉੁਹ ਖਾਤਮਾ ਕਰਨਾ ਕਰਨਾ ਪੈਂਦਾ ਹੈ ਕਿਉਂਕਿ ਪ੍ਰਦੂਸ਼ਣ ਨਾਲ ਲੋਕ ਜ਼ਿਆਦਾ ਤੋਂ ਜ਼ਿਆਦਾ ਮਰੀ ਜਾਂਦੇ ਹਨ ਇਸ ਲਈ ਸਾਨੂੰ ਪ੍ਰਦੂਸ਼ਣ ਨਹੀਂ ਪਾਉਣਾ ਚਾਹੀਦਾ ਕਿਉਂਕਿ ਸਾਨੂੰ ਦੂਜਿਆਂ ਨੂੰ ਰੋਕਣਾ ਚਾਹੀਦਾ ਹੈ